ਬੁਰਾ ਐਕਪੀਰੀਅੰਸ ਇਹ ਰਿਹਾ ਕਿ ਬਾਹਰੋਂਂ ਤੋਂ ਦੇਖਣ ਦੇ ਲਈ ਸ਼ੇਪ ਸਾਈਜ਼ ਤਾਂ ਵਧੀਆ ਸੀ ਪਰ ਜਦੋਂ ਅਸੀਂ ਉਹਨਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰਿਆ ਤਾਂ ਉਹ ਕੁਝ ਖਾਸ ਵਧੀਆ ਨਹੀਂ ਨਿਕਲੇ ਅਤੇ ਉਹ ਬਹੁਤ ਜਲਦੀ ਉਹਨਾਂ ਦੇ ਵਿੱਚ ਦਰਾਰਾਂ ਆ ਗਈਆਂ ਅਤੇ ਉਹ ਟੁੱਟ ਗਏ